ਪ੍ਰਿੰਟ ਮੀਡੀਆ ਅਖਬਾਰ ਅਤੇ ਮੈਗਜ਼ੀਨ ਅਤੇ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਆਪਾਂ ਇਹਦੇ ਵਿੱਚ ਦੇਖੀਏ ਤਾਂ ਪ੍ਰਿੰਟ ਮੀਡੀਆ ਜਿਹੜੀ ਖਬਰ ਲਿਖਦੀ ਹੈ ਛਾਪਦੀ ਹੈ ਕਾਫੀ ਹੱਦ ਤੱਕ ਰਿਸਰਚ ਵਰਕ ਹੁੰਦਾ ਆ ਉਹ ਪੂਰਾ ਜਾਂਚ ਪੜਤਾਲ ਕਰਕੇ ਉਸ ਖਬਰ ਨੂੰ ਛਾਪਦੀ ਹੈ ਕਿਉਂਕਿ ਇੱਕ ਵਾਰੀ ਲਿਖਿਆ ਹੋਇਆ ਚੀਜ਼ ਜਲਦੀ ਆਪਸ ਮਿਲਦੇ ਨਹੀਂ ਹੈ ਇਵੇਂ ਹੀ ਆਪਾਂ ਦੇਖੀਏ ਨਿਊਜ਼ ਚੈਨਲ ਨਿਊਜ਼ ਚੈਨਲ ਵੀ ਕਾਫੀ ਰਿਸਰਚ ਕਰਕੇ ਨਿਊਜ਼ ਨੂੰ ਹੀ ਚਲਾਉਂਦੀ ਹੈ ਦਿਖਾਉਂਦੀ ਹੈ ਜੋ ਰੂ ਬ ਰੂ ਜਿਹੜੀ ਘਟਨਾ ਹੁੰਦੀ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੰਦੀ ਹੈ ਪਰ ਇਹਦੇ ਵਿੱਚ ਕਈ ਵਾਰੀ ਆਪਾਂ ਦੇਖਦੇ ਕਿ ਸੋਸ਼ਲ ਮੀਡੀਆ ਵੀ ਕਾਫੀ ਹੱਦ ਤੱਕ ਸਾਨੂੰ ਅੱਛੀ ਜਾਣਕਾਰੀ ਦਿੰਦਾ ਆ ਅੱਛੀ ਨਿਊਜ਼ ਰਿਪੋਰਟ ਦਿੰਦਾ ਬਟ ਕਈ ਵਾਰੀ ਇੱਕ ਇੱਕ ਗਲਤ ਚੀਜ਼ ਨੇ ਵੀ ਕਾਫੀ ਪ੍ਰਮੋਟ ਕਰਦੇ ਵਾਇਰਲ ਵਾਂਗੂ ਫੈਲਦਾ ਕੋਈ ਵੀ ਨਿਊਜ਼ ਇਹ ਇੱਕ ਗਲਤ ਮੈਸੇਜ ਸੋਸ਼ਲ ਮੀਡੀਆ ਦੇ ਥਰੂ ਇਹ ਇੱਕ ਗਲਤ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਵਾਇਰਲ ਵਾਂਗੂ ਫੈਲਦਾ ਜਿਹਦੇ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਹੋ ਜਾਂਦਾ ਬੜਾ ਕੁਛ ਕਿਉਂਕਿ ਅਸੀਂ ਸੋਸ਼ਲ ਮੀਡੀਆ 'ਤੇ ਕਈ ਵਾਰ ਆਪਾਂ ਦੇਖਦੇ ਕਿ ਇੱਕ ਮੈਸੇਜ ਆਇਆ ਇੱਕ ਵੀਡੀਓ ਆਇਆ ਉਸ ਵੀਡੀਓ ਦੀ ਕੀ ਸੱਚਾਈ ਹੈ ਕੀ ਖਾਸੀਅਤ ਅਸੀਂ ਬਿਨਾਂ ਜਾਣ ਪਛਾਣ ਕੀਤੇ ਬਿਨਾ ਪੜਤਾਲ ਕੀਤੇ ਉਹਨੂੰ ਆਪਾਂ ਫਾਰਵਰਡ ਕਰ ਦਿੰਦੇ ਜਿਹਦਾ ਕਿ ਸਾਨੂੰ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਸਮਾਜ ਦੇ ਵਿੱਚ ਅਤੇ ਲੋਕ ਉਸਨੂੰ ਦੇਖ ਕੇ ਉਹ ਵੀ ਸੋਚਦੇ ਨਹੀਂ ਕਿ ਸਹੀ ਹੈ ਜਾਂ ਗਲਤ ਹੈ ਉਹਨੂੰ ਕਰ ਦਿੰਦੇ ਆ ਇਸ ਤੋਂ ਅੱਜ ਆਪਾਂ ਦੇਖੀਏ ਪ੍ਰਿੰਟ ਮੀਡੀਆ ਪ੍ਰਿੰਟ ਮੀਡੀਆ 'ਤੇ ਵੀ ਕਿ ਜਾਣਕਾਰੀ ਜਿਹੜੀ ਉਹ ਕਿਉਂਕਿ ਛਾਪਣ ਵੇਲੇ ਉਹਨੂੰ ਪੂਰਾ ਜਾਂਚ ਪੜਤਾਲ ਕੀਤਾ ਜਾਂਦਾ ਦੇਖਿਆ ਜਾਂਦਾ ਹੈ ਨਿਊਜ ਚੈਨਲ ਉੱਤੇ ਵੀ ਕਾਫੀ ਕੁਛ ਅੱਛਾ ਜਾਂਚ ਪੜਤਾਲ ਦੇ ਵਿੱਚ ਲਾਇਆ ਜਾਂਦਾ ਪਰ ਕਈ ਵਾਰੀ ਗਲਤ ਖਬਰਾਂ ਨੂੰ ਵੀ ਪ੍ਰਮੋਟ ਕੀਤਾ ਜਾਂਦਾ ਹੈ ਜਿਹਦੇ ਬਾਰੇ ਸਾਨੂੰ ਨੈਗੇਟਿਵ ਚੀਜ਼ ਪਤਾ ਜਿਸ ਕਈ ਵਾਰੀ ਇਸ ਵਿਚ ਖਬਰ ਹੁੰਦੀ ਜਿਹੜੀ ਕਿ ਸਮਾਜ ਦੇ ਵਿੱਚ ਗਲਤ ਦਿਸ਼ਾ ਦੇਵੇ ਅਤੇ ਇਸ ਤੋਂ ਵੀ ਸਾਨੂੰ ਰੋਕ ਲਗਾਉਣੀ ਚਾਹੀਦੀ ਹੈ ਕਿ ਗਲਤ ਮੈਸੇਜ ਨੂੰ ਨਾ ਲਾਈਨ ਅਪ ਕੀਤਾ ਜਾਵੇ ਜਿਸ ਕਰਕੇ ਕੀ ਸਾਰੇ ਸਮਾਜ ਦੇ ਵਿਚ ਅਰਾਜਕਤਾ ਫੈਲੇ ਕਈ ਵਾਰੀ ਸੱਚਾਈ ਹੁੰਦੀ ਹੈ ਨਿਊਜ ਦੇ ਵਿੱਚ ਬਟ ਉਸ ਚੀਜ਼ ਨੂੰ ਕਈ ਵਾਰੀ ਆਪਾਂ ਦਿਖਾਉਣਾ ਜ਼ਰੂਰੀ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਉਸ ਚੀਜ਼ ਨੂੰ ਦਿਖਾਉਂਦੇ ਜਿਹਦੇ ਕਰਕੇ ਸਮਾਜ ਦੇ ਵਿੱਚ ਕਾਫੀ ਬੁਰਾ ਪ੍ਰਭਾਵ ਪੈਂਦਾ ਔਰ ਸੋਸ਼ਲ ਮੀਡੀਆ 'ਤੇ ਕਾਫੀ ਹੱਦ ਤੱਕ ਦੇਖੀਏ ਤਾਂ ਅੱਛੀਆਂ ਚੀਜ਼ਾਂ ਤਾਂ ਆ ਹੀ ਰਹੀਆਂ ਪਰ ਸਾਥ ਸਾਥ ਇਹਦਾ ਦੁਸ਼ਪ੍ਰਣਾਮ ਵੀ ਹੈ ਜਿਵੇਂ ਕਿ ਇਸਨੂੰ ਰੋਕ ਲਗਾਉਣ ਵਾਸਤੇ ਇੱਕ ਕਾਫੀ ਹੱਥੋਂ ਸਰਕਾਰ ਨੂੰ ਕੋਸ਼ਿਸ਼ ਕਰਨੇ ਚਾਹੀਦਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਸਿਰਫ ਉਹੀ ਚੀਜ਼ ਹੁਣ ਜਿਵੇਂ ਕਿਸੇ ਵੀ ਮੈਸੇਜ ਜਾ ਕਿਸੇ ਵੀ ਵੀਡੀਓ ਦਾ ਆਪਾਂ ਤੱਥ ਕੱਢ ਸਕਦੇ ਕਿ ਉਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਸੱਚਾਈ ਹੈ ਅਤੇ ਇਸ ਟੂਲ ਨੂੰ ਮੀਡੀਆ ਸੋਸ਼ਲ ਮੀਡੀਆ 'ਤੇ ਵੀ ਵਾਸਤੇ ਪ੍ਰਿੰਟ ਮੀਡੀਆ 'ਤੇ ਵੀ ਅਤੇ ਨਿਊਜ਼ ਚੈਨਲਾਂ 'ਤੇ ਵੀ ਲਗਾਉਣੀ ਚਾਹੀਦੀ ਹੈ ਕਿ ਆਪਾਂ ਇਸ ਚੀਜ਼ ਦੀ ਜੋ ਵੀ ਸੱਚੀ ਔਰ ਅੱਛੀ ਖਬਰ ਉਹਨੂੰ ਹੀ ਜਨਤਾ ਦੇ ਸਾਹਮਣੇ ਲਿਆਇਆ ਜਾਵੇ ਨਾ ਕਿ ਗਲਤ ਮੈਸੇਜ ਗਲਤ ਵੀਡੀਓ ਨੂੰ ਹੀ ਅਪਲੋਡ ਕੀਤਾ ਜਾਏ ਜਿਹਦੇ ਕਰਕੇ ਸਮਾਜ ਦੇ ਵਿੱਚ ਵੀ ਔਰ ਅੱਛੀ ਚੀਜ਼ ਵੀ ਲੋਕਾਂ ਤੱਕ ਪਹੁੰਚ ਸਕੇ